ਦੌੜਨਾ ਦੌੜਨਾ ਸਿਹਤ ਲਈ ਬਹੁਤ ਹੀ ਚੰਗਾ ਹੁੰਦਾ ਹੈ ਮੈਂ ਖੁਦ ਵੀ ਦੌੜ ਲਾਉਂਦਾ ਹੈ ਅਤੇ ਮੈਂ ਇਸ ਲਈ ਸਾਡੇ ਸੋਸਾਇਟੀ ਵਿੱਚ ਇੱਕ ਬਹੁਤ ਵਧੀਆ ਟਰੈਕ ਵੀ ਬਣਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਬੱਚੇ ਦੌੜ ਲਾਉਂਦੇ ਹਨ ਅਤੇ ਦੌੜਨ ਨਾਲ ਤੁਹਾਡਾ ਸਰੀਰ ਵੀ ਫਿੱਟ ਰਹਿੰਦਾ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ ਅਗਰ ਤੁਸੀਂ ਕੋਈ ਵੀ ਗੇਮ ਕਰਦੇ ਹੋ ਤਾਂ ਤੁਹਾਡੀ ਜਿਹੜੀ ਸਪੀਡ ਦੌੜਨ ਲਈ ਦੌੜ ਜਿਹੜੀ ਤੁਹਾਡੀ ਹੋਣੀ ਚਾਹੀਦੀ ਹੈ ਕਿਉਂਕਿ ਦੌੜਨ ਨਾਲ ਹੀ ਤੁਸੀਂ ਸਭ ਕੁਝ ਕਰ ਸਕਦੇ ਹੋ ਇਸ ਤੋਂ ਬਿਨਾਂ ਕੁਝ ਨਹੀਂ ਐ ਇਸ ਆਮ ਆਮ ਤੌਰ 'ਤੇ ਵੀ ਥੋਡੀ ਹੱਡੀਆਂ ਨੂੰ ਮਜ਼ਬੂਤੀ ਲਈ ਤੁਹਾਨੂੰ ਕੁਛ ਨਾ ਕੁਛ ਦੌੜਨਾ ਜ਼ਰੂਰ ਚਾਹੀਦਾ ਅਤੇ ਸਭ ਉਹ ਦੌੜ ਲਾਉਣ ਲਈ ਸਭ ਤੋਂ ਵਧੀਆ ਸਮਾਂ ਸਵੇਰ ਦਾ ਸਮਾਂ ਹੈ ਜਿਸ ਵਿੱਚ ਤੁਸੀਂ ਇੱਕ ਵਧੀਆ ਹਵਾ ਨੂੰ ਆਪਣੇ ਅੰਦਰ ਸਰੀਰ ਵਿੱਚ ਲਿਆਉਂਦੇ ਹੋ ਜਿਸ ਨਾਲ ਤੁਹਾਡੇ ਅੰਦਰ ਇੱਕ ਅਲੱਗ ਤਰ੍ਹਾਂ ਦਾ ਜਨੂੰਨ ਚੁਸਤੀ ਫਰੂਸਤੀ ਇੱਕ ਨੂਰ ਜਿਹਾ ਤੁਹਾਡੇ ਸਰੀਰ 'ਤੇ ਪੈਂਦਾ ਹੈ ਜਿਸ ਨਾਲ ਤੁਹਾਡੀ ਲੁਕ ਵੀ ਚੇਂਜ ਹੋ ਜਾਂਦੀ ਹੈ ਟਰੈਡੀਮਿਲ ਟਰੈਡੀਮਿਲ ਇੱਕ ਮਸ਼ੀਨੀ ਜੰਤਰ ਹੈ ਜਿਸ ਵਿੱਚ ਤੁਸੀਂ ਘਰ ਬੈਠੇ ਹੀ ਤੁਸੀਂ ਦੌੜ ਲਗਾ ਸਕਦੇ ਹੋ ਉਸ ਕੰਪਿਊਟਰ ਰਾਹੀਂ ਮਸ਼ੀਨ ਰਾਹੀਂ ਤੁਸੀਂ ਆਪਣੀ ਦੌੜ ਨੂੰ ਨਿਯੰਤਰ ਕਰ ਸਕਦੇ ਹੋ ਸਪੀਡ ਘਟਾ ਵਧਾ ਸਕਦੇ ਹੋ ਅਤੇ ਤੁਸੀਂ ਕੋਈ ਵੀ ਮਤਲਬ ਹਰ ਵੇਲੇ ਲਾ ਸਕਦੇ ਹੋ ਕਿਸੇ ਟਾਈਮ ਵੀ ਲਾ ਸਕਦੇ ਹੋ ਕਿਉਂਕਿ ਇਹ ਮਸ਼ੀਨ ਦੁਆਰਾ ਲਾਈ ਲਗਾਈ ਗਈ ਦੌੜ ਹੈ ਜਿਸ ਵਿੱਚ ਤੁਸੀਂ ਕ ਕੋਈ ਵੀ ਮੌਸਮ ਖਰਾਬੀ ਹੋਵੇ ਤਾਂ ਵੀ ਤੁਸੀਂ ਇਸ ਉੱਪਰ ਦੌੜ ਲਗਾ ਸਕਦੇ ਹੋ ਪਰ ਜ਼ਮੀਨੀ ਦੌੜ ਜਿਹੜੀ ਹੈ ਇਹ ਟਰੈਡੀਮਲ ਦੌੜ ਤੋਂ ਮਸ਼ੀਨੀ ਦੌੜ ਤੋਂ ਬਹੁਤ ਹੀ ਜ਼ਿਆਦਾ ਬਿਹਤਰ ਅਤੇ ਹੁੰਦੀ ਵ ਵਧੀਆ ਹੁੰਦੀ ਹੈ ਕਿਉਂਕਿ ਇਸ ਵਿੱਚ ਤੁਹਾਡਾ ਖੁਦ ਦਾ ਜ਼ੋਰ ਹੁੰਦਾ ਹੈ ਕਿਉਂਕਿ ਜ਼ਮੀਨੀ ਤੌਰ 'ਤੇ ਇੱਕੋ ਜਿਹੀ ਨਹੀਂ ਹੁੰਦੀ ਤੁਸੀਂ ਇਸ ਨੂੰ ਗਰਾਊਂਡ ਇਲਾਕੇ ਵਿੱਚ ਵਰਤਿਆ ਜਿੱਥੇ ਜ਼ਮੀਨ ਪੋਲੀ ਹੁੰਦੀ ਹੈ ਰੇਤਲੀ ਹੁੰਦੀ ਹੈ ਜਿਸ ਵਿੱਚ ਤੁਹਾਡੇ ਸਰੀਰ ਦਾ ਜ਼ਿਆਦਾ ਜ਼ੋਰ ਲੱਗਦਾ ਹੈ ਇੱਕ ਜ਼ਿਆਦਾ ਤਾਕਤ ਲੱਗਦੀ ਹੈ ਜਿਸ ਨਾਲ ਤੁਹਾਡੀਆਂ ਮਾਸ਼ਪੇਸ਼ੀਆਂ ਵਿੱਚ ਇੱਕ ਅਲੱਗ ਤੋਂ ਜਾਨ ਪੈਦਾ ਹੁੰਦੀ ਹੈ ਮਸ਼ੀਨ ਟਰੈਡੀਮਿਲ ਦੌੜ ਲਾਉਣ ਦਾ ਤੁਹਾਡੀ ਇੱਕ ਸਮਤਲ ਇੱਕ ਪਲੇਨ ਰੋਡ ਵਰਗੀ ਹੈ ਜਿਸ ਵਿੱਚ ਤੁਹਾਨੂੰ ਬਹੁਤਾ ਫਰਕ ਨਹੀਂ ਨਜ਼ਰ ਆਉਂਦਾ ਹੈ ਪਰ ਜ਼ਮੀਨੀ ਦੌੜ 'ਤੇ ਤੁਸੀਂ ਵੱਖ ਵੱਖ ਵੱਖ ਜ਼ਮੀਨੀ ਤੌਰ 'ਤੇ ਵੀ ਦੌੜ ਅਗਰ ਤੁਸੀਂ ਲਗਾਉਂਦੇ ਹੋ ਤਾਂ ਤੁਹਾਨੂੰ ਇੱਕ ਸਰੀਰ 'ਚ ਅਲੱਗ ਹੀ ਚੇਂਜ ਆਉਂਦਾ ਹੈ ਜਿਸ ਨਾਲ ਤੁਸੀਂ ਇੱਕ ਮਸ਼ੀਨ ਟਰੈਡੀਮਿਲ ਦੇ ਦੁਆਰਾ ਲਾ ਕੀਤੀ ਗਈ ਤਿਆਰੀ ਤੋਂ ਜ਼ਮੀਨੀ ਦੌੜ ਦੀ ਤਿਆਰੀ ਬਹੁਤ ਹੀ ਵਧੀਆ ਮੰਨੀ ਜਾਂਦੀ ਹੈ